ਮੈਂ ਬਹੁਤ ਸਾਰੇ ਬਹੁਤ ਵਾਰ ਖਾਣਾ ਬਣਾਇਆ ਜਿਸ ਤਰ੍ਹਾਂ ਕਿ ਬਹੁਤ ਸਾਰੇ ਲੋਕਾਂ ਲਈ ਜਿਸ ਤਰ੍ਹਾਂ ਮੈਂ ਗੁਰਦੁਆਰਾ ਸਾਹਿਬ ਵਿੱਚ ਕੋਈ ਵੀ ਪ੍ਰੋਗਰਾਮ ਹੁੰਦਾ ਹੈ ਤਾਂ ਅਸੀਂ ਕਾਫੀ ਸਾਰੀਆਂ ਜਨਾਨੀਆਂ ਇਕੱਠੀਆਂ ਹੋ ਕੇ ਗੁਰੂ ਕਾ ਲੰਗਰ ਤਿਆਰ ਕਰਦੀਆਂ ਹਾਂ ਉਹਦੇ ਵਿੱਚ ਮੈਂ ਕੁਛ ਚੀਜ਼ਾਂ ਜਿਹੜੀਆਂ ਕਿ ਆਪ ਖੁਦ ਬਣਾ ਬਣਾਉਦੀ ਹਾਂ ਮੈਨੂੰ ਕਿ ਖਾਣਾ ਬਣਾਉਣਾ ਬਹੁਤ ਪਸੰਦ ਹੈ ਇਸ ਤੋਂ ਇਲਾਵਾ ਜਦ ਮੈਂ ਮੇਰੇ ਇਸ ਤੋਂ ਵ ਇਲਾਵਾ ਗੱਲ ਕਰੀਏ ਤਾਂ ਮੈਂ ਆਪਣੇ ਪੋਤਰੇ ਦੇ ਜਨਮ ਦਿਨ 'ਤੇ ਸ ਸੌ ਲੋਕਾਂ ਦਾ ਖਾਣਾ ਖੁਦ ਬਣਾਇਆ ਸੀ ਜਿਹਦੇ ਵਿੱਚ ਸਭ ਤੋਂ ਪਹਿਲਾਂ ਕਿ ਪਕੌੜੇ ਪਕੌੜਿਆਂ ਲਈ ਪਹਿਲਾਂ ਵੇਸਣ ਘੋਲਿਆ ਫਿਰ ਉਹਦੇ ਵਿੱਚ ਆਲੂ ਪਿਆਜ਼ ਪਿਆਜ਼ ਚੀਰੇ ਆਲੂ ਪਿਆਜ਼ ਚੀਰ ਕੇ ਹਰੀਆਂ ਮਿਰਚਾਂ ਚੀਰ ਕੇ ਵੇਸਣ ਪਾ ਕੇ ਉਹਦੇ ਵਿੱਚ ਥੋੜ੍ਹਾ ਜਿਹਾ ਦਹੀਂ ਪਾ ਕੇ ਨਮਕ ਮਸਾਲਾ ਪਾ ਕੇ ਥੋੜ੍ਹਾ ਜਿਹਾ ਬੇਕਿੰਗ ਪਾਊਡਰ ਪਾ ਕੇ ਉਹਨੂੰ ਘੋਲ ਲਿਆ ਉਹਦੇ ਘੋਲ ਕੇ ਫਿਰ ਦੂਜੇ ਪਾਸੇ ਤੇਲ ਗਰਮ ਹੋਣ ਲਈ ਰੱਖ ਦਿੱਤਾ ਤੇਲ ਵਿੱਚ ਥੋੜ੍ਹੇ ਥੋੜ੍ਹੇ ਛੋਟੇ ਛੋਟੇ ਛੋਟੇ ਸਾਈਜ਼ ਦੇ ਪਕੌੜੇ ਕੱਢ ਲਏ ਵਚ ਬਰੈਡ ਵਾਲੇ ਪਕੌੜੇ ਕੁਛ ਬਰੈਡ ਵਾਲੇ ਕੱਢੇ ਕੁਛ ਪਨੀਰ ਵਾਲੇ ਪਕੌੜੇ ਕੱਢ ਕੇ ਸਾਰਾ ਕੁਛ ਬਣਾ ਕੇ ਇੱਕ ਸਾਈਡ 'ਤੇ ਰੱਖ ਲਿਆ ਉਸ ਤੋਂ ਇਲਾਵਾ ਮੈਂ ਜਿਸ ਤਰ੍ਹਾਂ ਕਿ ਸਬਜ਼ੀ ਵਿੱਚ ਦਾਲ ਦਾਲ ਮੱਖਣੀ ਬਣਾਈ ਮਟਰ ਪਨੀਰ ਬਣਾਇਆ ਅਤੇ ਮਿਕਸ ਬਣਾਏ ਮਿਕਸ ਵਿੱਚ ਸਭ ਤੋਂ ਪਹਿਲਾਂ ਗ ਸ਼ਿਮਲਾ ਮਿਰਚਾਂ ਸ਼ਿਮਲਾ ਮਿਰਚਾਂ ਗਾਜਰਾਂ ਗੋਭੀ ਗੋਭੀ ਫਲੀਆਂ ਭਿੰਡੀਆਂ ਬੈਂਗਣ ਸਾਰੀਆਂ ਚੀਜ਼ਾਂ ਨੂੰ ਛੋਟਾ ਛੋਟਾ ਕੱਟ ਲਿਆ ਉਹਨਾਂ ਨੂੰ ਇੱਕ ਸਾਈਡ 'ਤੇ ਰੱਖ ਕੇ ਧੋ ਕੇ ਇੱਕ ਸਾਈਡ 'ਤੇ ਰੱਖ ਦਿੱਤਾ ਉਸ ਤੋਂ ਬਾਅਦ ਪਿਆਜ਼ ਨੂੰ ਪਿਆਜ਼ ਜ਼ਿਆਦਾ ਚੀ ਪਿਆਜ਼ ਚੀਰੇ ਉਹਦੇ ਵਿੱਚ ਚੀਰ ਕੇ ਲੰਬੇ ਲੰਬੇ ਪਿਆਜ਼ ਇੱਕ ਸਾਈਡ 'ਤੇ ਰੱਖ ਲਏ ਫਿਰ ਥੋੜ੍ਹਾ ਜਿਹਾ ਲਸਣ ਅਦਰਕ ਅਤੇ ਟਮਾਟਰ ਮਿਰਚਾਂ ਸਾਰਾ ਕੁਛ ਗ੍ਰੈਂਡ ਕਰ ਲਿਆ ਕਰਕੇ ਫਿਰ ਉਸ ਤੋਂ ਬਾਅਦ ਮੈਂ ਵੱਡੇ ਜਿਹੇ ਕੜਾਹੀ ਵਿੱਚ ਤੇਲ ਪਾ ਕੇ ਉਹਦੇ ਵਿੱਚ ਫਿਰ ਉਹਦੇ ਵਿੱਚ ਜੀਰਾ ਅਜਵੈਣ ਪਾ ਕੇ ਉਸਨੂੰ ਤੜਕਾ ਪਿਆਜ਼ ਉਸ ਤੋਂ ਬਾਅਦ ਲਸਣ ਅਦਰਕ ਦਾ ਪੇਸਟ ਪਾ ਕੇ ਪਿਆਜ਼ ਪਾ ਕੇ ਭੁੰਨ ਲਏ ਭੁੰਨ ਕੇ ਫਿਰ ਸਭ ਵਿੱਚ ਹਲਦੀ ਲੂਣ ਮਸਾਲੇ ਪਾ ਕੇ ਉਸ ਤੋਂ ਇਲਾਵਾ ਮੈਂ ਉਹਦੇ ਵਿੱਚ ਮਸਾਲੇ ਪਾ ਕੇ ਫਿਰ ਉਹਦੇ ਵਿੱਚ ਜਿੰਨੀ ਵੀ ਸਬਜ਼ੀ ਸਾਰੀ ਨੂੰ ਪਾ ਕੇ ਸਬਜ਼ੀ ਬਣਾ ਲਈ ਜੋ ਕਿ ਬਹੁਤ ਵਧੀਆ ਬਣੀ ਇਸ ਤੋਂ ਇਲਾਵਾ ਮੈਂ ਹੋਰ ਵੀ ਕਈ ਚੀਜ਼ਾਂ ਬਣਾਈਆਂ ਜੋ ਕਿ ਸਾਰਿਆਂ ਨੇ ਬਹੁਤ ਪਸੰਦ ਕੀਤੀਆਂ